ਵੱਡੇ ਅਤੇ ਛੋਟੇ ਬਿਜਨਸਮੈਨ ਬਾਰੇ

ਲਈ ਬਿਜਨਸ ਕਰਦਾ ਹੈ ਦੀ ਇੰਡੀਪੈਂਡਿਡ ਰਹਿੰਦਾ ਹੈ ਜੋ ਵੱਡਾ ਬਿਜ਼ਨਸਮੈਨ ਹੁੰਦਾ ਹੈ ਉਹ ਦੂਜੀ ਵਿਅਕਤੀ ਨੂੰ ਵੀ ਨੌਕਰੀ 'ਤੇ ਰੱਖਦਾ ਹੈ ਅਤੇ ਉਸ ਨੂੰ ਵੀ ਨੌਕਰੀ ਮਿਲਦੀ ਹੈ ਅਤੇ ਉਹ ਸਪੋਰਟ ਐਕਸਪੋਰਟ ਵੀ ਕਰਦਾ ਹੈ ਇਸ ਤਰ੍ਹਾਂ ਵੱਡਾ ਬਿਜ਼ਨਸਮੈਨ ਹੈ ਉਹ ਕਾਫੀ ਵਿਅਕਤੀਆਂ ਨੂੰ ਰੁਜ਼ਗਾਰ ਦੇ ਸਕਦਾ ਹੈ ਅਤੇ ਕਾਫੀ ਘਰਾਂ ਦੇ ਵਿੱਚ ਖੁਸ਼ਹਾਲੀ ਆ ਸਕਦੀ ਹੈ ਅਤੇ ਛੋਟਾ ਬਿਜਨਸਮੈਨ ਹੈ ਜੋ ਉਹ ਆਪਣੀ ਭੂਮਿਕਾ ਆਪ ਹੀ ਨਿਭਾਉਂਦਾ ਹੈ ਅਤੇ ਉਹ ਕਿਸੇ ਨੂੰ ਜ਼ਿਆਦਾ ਰੁਜ਼ਗਾਰ ਨਹੀਂ ਦੇ ਪਾਉਂਦਾ